ਮੈਂ ਆਪਣੀਆਂ ਡਰਾਇੰਗਾਂ ਵਿੱਚ ਗਤੀਸ਼ੀਲਤਾ ਨੂੰ ਬਹੁਤ ਵਧੀਆ ਢੰਗ ਨਾਲ ਸ਼ਾਮਿਲ ਕਰਦਾ ਹਾਂ ਕਿਉਂਕਿ ਇਹਨਾਂ ਦੀ ਚਿੱਤਰ ਬਣਾ ਕੇ ਅੱਡੋ ਅੱਡ ਰੰਗ ਭਰ ਕੇ ਉਹਨਾਂ ਨੂੰ ਚੰਗੀ ਤਰ੍ਹਾਂ ਸ਼ਾਮਿਲ ਕਰਦਾ ਹਾਂ ਇਸ ਦੀ ਮੈਂ ਉਦਾਹਰਣ ਵੀ ਦੇ ਸਕਦਾ ਹਾਂ ਕਿਉਂਕਿ ਇਹਨਾਂ ਦੀ ਗਤੀਸ਼ੀਲਤਾ ਬਹੁਤ ਵਧੀਆ ਢੰਗ ਨਾਲ ਕੀਤੀ ਜਾਂਦੀ ਹੈ ਜਿਵੇਂ ਕਿ ਮੈਂ ਵਰਣਨ ਕਰਦਾ ਹਾਂ ਇੱਕ ਦਿਨ ਮੈਂ ਆਪਣੇ ਘਰ ਦੀ ਛੱਤ ਉੱਪਰ ਬੈਠਾ ਸੀ ਉਸੇ ਉਸੇ ਤਰ੍ਹਾਂ ਉਥੋਂ ਇੱਕ ਕਬੂਤਰਾਂ ਦਾ ਛੇ ਸੱਤ ਕਬੂਤਰ ਲੰਘੇ ਜਦੋਂ ਉਹ ਜਾ ਰਹੇ ਸੀ ਤਾਂ ਮੈਂ ਉਹਨਾਂ ਨੂੰ ਸੋਚਿਆ ਵੀ ਇਹਨਾਂ ਨੂੰ ਮੈਂ ਆਪਣੀ ਡਰਾਇੰਗ ਵਿੱਚ ਸ਼ਾਮਿਲ ਕਰਾਂ ਇਸ ਨੂੰ ਕੈਪਚਰ ਕੀਤਾ ਜਾਵੇ ਮੈਂ ਫੇਰ ਉਸ ਨੂੰ ਆਪਣੀ ਡਰੈਂਗ ਵਿੱਚ ਕੈਪਚਰ ਕੀਤਾ ਕੈਪਚਰ ਕਰਕੇ ਉਹਨਾਂ ਵਿੱਚ ਜਦੋਂ ਮੈਂ ਉਸੇ ਤਰ੍ਹਾਂ ਦੇ ਅੱਡੋ ਅੱਡ ਰੰਗ ਭਰੇ ਜਿਵੇਂ ਜਿਵੇਂ ਦੇ ਕਬੂਤਰਾਂ ਦੇ ਰੰਗ ਸੀ ਅਤੇ ਉਵੇਂ ਉਵੇਂ ਬਣਾ ਕੇ ਦੇਖੇ ਤਾਂ ਉਹ ਬਹੁਤ ਹੀ ਵਧੀਆ ਲੱਗੇ